ਇਹ ਲੋਕ ਨਾਚ ਮੰਨਿਆ ਜਾਂਦਾ ਪੰਜਾਬ ਦਾ ਯਾਨੀ ਕਿ ਇਹਨੂੰ ਯਾਨੀ ਕਿ ਜਿਹੜੇ ਬ ਹਰੇਕ ਬੱਚਾ ਹਰੇਕ ਉਮਰ ਦਾ ਯਾਨੀ ਕਿ ਭੰਗੜੇ ਨੂੰ ਜਿਹੜਾ ਜੈ ਜਿਹਨੇ ਜਿਵੇਂ ਆਪਣੇ ਘਰਾਂ ਦੇ ਵਿੱਚ ਜਿਵੇਂ ਆਪਾਂ ਫੰਕਸ਼ਨ ਕਰਦੇ ਹਾਂ ਸਾਰੇ ਹੀ ਇਹਨੂੰ ਪਸੰਦ ਕਰਦੇ ਆ ਮਤਲਬ ਬੱਚੇ ਤੋਂ ਬੱਚਾ ਛੋਟੇ ਤੋਂ ਛੋਟਾ ਵੀ ਇਹਨੂੰ ਯਾਨੀ ਕਿ ਭੰਗੜੇ ਨੂੰ ਚੰਗਾ ਸਮਝਦਾ ਉਹਨੂੰ ਦੇਖਣਾ ਪਸੰਦ ਕਰਦੇ ਆ ਪਾਉਣਾ ਵੀ ਪਸੰਦ ਕਰਦੇ ਆ ਜਿਹੜਾ ਯਾਨੀ ਕਿ ਜਿਹੜਾ ਜਿਵੇਂ ਹੁਣ ਇਹਦੇ ਨਾਲ ਆਪਣੇ ਭੰਗੜਾ ਜਦੋਂ ਆਪਾਂ ਸਟੈਪ ਬਾਈ ਸਟੈਪ ਕਰਦੇ ਇਹਦੇ 'ਚ ਕਈ ਤਰ੍ਹਾਂ ਦੇ ਸਟੈਪ ਹੁੰਦੇ ਨੇ ਜਿਹੜੇ ਕਿ ਜਿਹੜੇ ਆਪਣੀ ਯਾਨੀ ਕਿ ਸ਼ਰੀਰ ਨੂੰ ਤੰਦਰੁਸਤ ਵੀ ਰੱਖਦੇ ਨੇ ਯਾਨੀ ਕਿ ਜਿਵੇਂ ਤੰਦਰੁਸਤ ਰੱਖਦੇ ਆ ਫਿਰ ਯਾਨੀ ਕਿ ਇਹਦੇ ਵਿੱਚ ਆਪਾਂ ਜਿਵੇਂ ਆ ਪੰਜਾਬੀ ਗਾਣੇ ਹੁੰਦੇ ਆ ਉਹਦੇ ਵਿੱਚੋਂ ਆਪਾਂ ਸਟੈਂਜੇ ਕੱਢ ਕੇ ਯਾਨੀ ਕਿ ਜਿਹੜੇ ਆਪਾਂ ਆਪਣੇ ਪੈਰਾਗ੍ਰਾਫ ਹੁੰਦੇ ਨੇ ਹੈ ਨਾ ਪੈਰੇ ਹੁੰਦੇ ਨੇ ਉਹਨੂੰ ਉਹਨਾਂ ਦੇ ਉੱਤੇ ਵੀ ਆਪਾਂ ਯਾਨੀ ਕਿ ਇਹ ਸਟੈਪ ਵਰਤ ਸਕਦੇ ਹਾਂ ਗਾਣਿਆਂ 'ਤੇ ਵੀ ਆਪਾਂ ਯਾਨੀ ਕਿ ਇਹ ਸਟੈਪ ਵਰਤ ਲੈਂਦੇ ਹਾਂ ਯਾਨੀ ਕਿ ਵਧੀਆ ਲੱਗਦਾ ਗਾ ਅਤੇ ਜਿਹੜਾ ਇਹ ਜਿਵੇਂ ਹੁਣ ਇੱਕ ਮਲਵਈ ਗਿੱਧਾ ਹੁੰਦਾ ਇਹਦੇ ਵਿੱਚ ਭੰਗੜੇ ਦੇ ਵਿੱਚ ਉਹਨੂੰ ਵੀ ਪੰਜਾਬ ਯਾਨੀ ਕਿ ਇਹ ਇਹ ਆਪਣਾ ਭੰਗੜੇ ਦਾ ਹੀ ਇੱਕ ਪਾਰਟ ਸਮਝਿਆ ਜਾਂਦਾ ਜਿਹੜਾ ਮਲਵਈ ਗਿੱਧਾ ਅਤੇ ਕੁੜੀਆਂ ਅਲੱਗ ਤਰ੍ਹਾਂ ਪਾ ਲੈਂਦੀਆਂ ਅਤੇ ਮੁੰਡੇ ਅਲੱਗ ਤਰ੍ਹਾਂ ਪਾ ਲੈਂਦੇ ਆ ਅਤੇ ਜਿਹੜੇ ਛੋਟੇ ਤੋਂ ਛੋਟਾ ਬੱਚਾ ਵੀ ਅੱਜ ਕੱਲ੍ਹ ਯਾਨੀ ਕਿ ਇਹਨੂੰ ਪਾਉਣਾ ਪਸੰਦ ਕਰਦਾ ਅਤੇ ਇਹ ਆਪਾਂ ਯਾਨੀ ਕਿ ਜਿਹੜਾ ਭੰਗੜਾ ਹੈ ਭੰਗੜਾ ਪਾਉਣ ਨਾਲ ਮਤਲਬ ਆਪਣੀ ਜਿਹੜੀ ਜੁਇਨਟ ਫੈਮਲੀ ਦੇ ਵਿੱਚ ਕੋਈ ਵੀ ਆਪਾਂ ਛੋਟਾ ਮੋਟਾ ਫੰਕਸ਼ਨ ਰੱਖ ਲੈਂਦੇ ਹਾਂ ਲੋਕੀ ਇਹਦੇ 'ਤੇ ਭੰਗ ਗਾਣਿਆਂ 'ਤੇ ਭੰਗੜਾ ਪਾ ਕੇ ਫੁੱਲ ਇੰਜੋਏ ਕਰਨਾ ਚੰਗਾ ਸਮਝਦੇ ਆ ਯਾਨੀ ਕੋਈ ਇਹ ਨਹੀਂ ਹੈਗਾ ਕਿ ਇਹ ਕੋਈ ਇਹ ਕਪ ਕਪ ਜਦੋਂ ਆਪਾਂ ਘਰੇ ਜਿਵੇਂ ਕੋਈ ਫੰਕਸ਼ਨ ਰੱਖਦੇ ਹਾਂ ਉਹਦੇ ਮੁਤਾਬਿਕ ਤਾਂ ਆਪਾਂ ਜਿਵੇਂ ਮਰਜ਼ੀ ਆਪਾਂ ਤਿਆਰ ਹੋਏ ਵੇ ਆ ਉਵੇਂ ਆਪਾਂ ਫੰਕਸ਼ਨ 'ਤੇ ਨੱਚਣ ਲੱਗ ਜਾਨੇ ਆ ਭੰਗੜਾ ਪਾਉਣ ਲੱਗ ਜਾਨੇ ਆ ਜੈਂਟਸ ਅਲੱਗ ਲੱਗੇ ਹੁੰਦੇ ਲੇਡੀਜ ਅਲੱਗ ਲੱਗੀਆਂ ਹੁੰਦੀਆਂ ਉਹ ਬੰਦੇ ਬੁੜੀਆਂ ਮਤਲਬ ਅਲੱਗ ਅਲੱਗ ਕਰ ਰਹੀਆਂ ਨੇ ਅਤੇ ਖੁਸ਼ ਵੀ ਹੁੰਦੇ ਨੇ ਇਹ ਚੀਜ਼ਾਂ ਹੁਣ ਜੇ ਆਪਾਂ ਆਮ ਦੂਸਰਾ ਡਾਂਸ ਕਰਦੇ ਹਾਂ ਹੁੰਦਾ ਤਾਂ ਹੈ ਕਿ ਹਰੇਕ ਨੂੰ ਆਪਣੇ ਆਪਣੇ ਸ਼ਹਿਰ ਦੇ ਮੁਤਾਬਿਕ ਮਤੇ ਵਧੀਆ ਲੱਗਦਾ ਆਪਣੇ ਆਪਣੇ ਡਾਂਸ ਕਰਨੇ ਪਰ ਜਿਹੜਾ ਪੰਜਾਬ ਦਾ ਇਹ ਭੰਗੜਾ ਮਤਲਬ ਇਹਦੇ ਉਤੇ ਯਾਨੀ ਕਿ ਜਿਹੜੇ ਪੰਜਾਬੀ ਉਹ ਤਾਂ ਖਾਸ ਕਰਕੇ ਬੜੇ ਖੁਸ਼ ਹੁੰਦੇ ਨੇ ਬੜੇ ਹੀ ਖੁਸ਼ ਹੁੰਦੇ ਨੇ ਇਹ ਪਾ ਕੇ ਇੰਜੋਏ ਫੁੱਲ ਕਰਦੇ ਨੇ ਆਪਦਾ ਫੈਮਿਲੀ 'ਚ ਵੀ ਅਤੇ ਇਹਨੂੰ ਯਾਨੀ ਕਿ ਯਾਨੀ ਕਿ ਮੇ ਮੇਰੇ ਮੁਤਾਬਿਕ ਤਾਂ ਇਹ ਬਿਲਕੁਲ ਹੀ ਸਹੀ ਆ ਕਿ ਇਹਨੂੰ ਵੱਧ ਤੋਂ ਵੱਧ ਯਾਨੀ ਕਿ ਅੱਗੇ ਲੈ ਕੇ ਜਾਣਾ ਚਾਹੀਦਾ ਭੰਗੜੇ ਨੂੰ ਕੋਈ ਵੀ ਆ ਬੱਚੇ ਨੂੰ ਛੋਟੀ ਛੋਟੀ ਉਮਰ ਤੋਂ ਹੀ ਯਾਨੀ ਕਿ ਯਾਨੀ ਕਿ ਲੈ ਕੇ ਜਾਣਾ ਚਾਹੀਦਾ ਭੰਗੜੇ ਨੂੰ ਪਹਿਲੇ ਨੰਬਰ 'ਤੇ ਸਮਝਿਆ ਜਾਣਾ ਚਾਹੀਦਾ ਪੰਜਾਬ ਦੇ ਵਿੱਚ ਜਿਹੜਾ ਅੱਜ ਕੱਲ੍ਹ ਬੱਚੇ ਯਾਨੀ ਕਿ ਇਹਦੇ 'ਚ ਭੁੱਲਦੇ ਜਾਂਦੇ ਨੇ ਹੈ ਨਾ ਉਹਨਾਂ ਨੂੰ ਦੱਸਣਾ ਚਾਹੀਦਾ ਮਾਂ ਬਾਪ ਨੂੰ ਟੀਚਰਜ ਨੂੰ ਦੱਸਣਾ ਚਾਹੀਦਾ ਇਹਦੇ ਵਿੱਚ ਪਹਿਰਾਵੇ ਦੇ ਨਾਲ ਇਹਨੂੰ ਯਾਨੀ ਕਿ ਜਿਵੇਂ ਆਪਣੀਆਂ ਜਿਹੜੇ ਪਹਿਲਾਂ ਮੰਮੀਆਂ ਸੀ ਆਪਣੀਆਂ ਹੈ ਨਾ ਉਹ ਆਪਾਂ ਨੂੰ ਦੱਸਦੀਆਂ ਹੁੰਦੀਆਂ ਸੀ ਇਹਦੇ ਵਿੱਚ ਯਾਨੀ ਕਿ ਜਿਹੜੇ ਚਰਖਾ ਰੱਖ ਕੇ ਲੋਕ ਨਾਚ ਕੀਤੇ ਜਾਂਦੇ ਆ ਜਿਹੜੀਆਂ ਕਹੀਆਂ ਵਗੈਰਾ ਸਾਰਾ ਕੁਝ ਪੰਜਾਬੀ ਵਿਰਸਾ ਦਿਖਾਉਂਦੇ ਆ ਆਪਾਂ ਨੂੰ ਜਿਵੇਂ ਆਪਾਂ ਵਿਆਹਵਾਂ 'ਤੇ ਜਾਨੇ ਆ ਸਟੇਜ 'ਤੇ ਰੱਖੇ ਹੁੰਦੇ ਆ ਉਹਨਾਂ ਨੇ ਪੰਜਾਬੀ ਖੂਹੀ ਬਣਾਈ ਹੁੰਦੀ ਆ ਉਹ ਭੰਗੜੇ ਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਮਤਲਬ ਬੱਚਿਆਂ ਨੂੰ ਪਤਾ ਲੱਗਦਾ ਖੂਹੀ ਕੀ ਚੀਜ਼ ਆ ਖੂਹੀ ਕੀ ਚੀਜ਼ ਹੈ ਚਰਖਾ ਕੀ ਚੀਜ਼ ਹੈ ਜਿਹੜੀਆਂ ਖੱਡੀਆਂ ਖੁੱਡੀਆਂ ਸਭ ਉਹਨਾਂ ਨੇ ਸਿੱਧਾ ਮਧਾਣੀਆਂ ਮੰਗਾੜਾ ਵਗੈਰਾ ਸਾਰਾ ਕੁਝ ਦੱਸਿਆ ਹੁੰਦਾ ਉਹ ਸਾਰਾ ਯਾਨੀ ਕਿ ਇਸ ਪੰਜਾਬੀ ਭੰਗੜੇ ਦੇ ਨਾਲ ਹੀ ਆਪਾਂ ਨੂੰ ਯਾਨੀ ਕਿ ਪਰੋਪਰ ਪਤਾ ਲੱਗਣ ਲੱਗ ਜਾਂਦਾ ਬੱਚਿਆਂ ਨੂੰ ਵਧੀਆ ਲੱਗਦਾ